ਭੰਗੜਾ ਪੰਜਾਬ ਦੇ ਵਿਰਸੇ ਨੂੰ ਬਹੁਤ ਖੂਬਸੂਰਤੀ ਨਾਲ ਦਰਸਾਉਂਦਾ ਹੈ ਇਹ ਸਿਰਫ ਇੱਕ ਨਾਚ ਨਹੀਂ ਸਗੋਂ ਪੰਜਾਬ ਦੀਆਂ ਰੀਤਾਂ ਸੱਭਿਆਚਾਰਕ ਅਤੇ ਇਤਿਹਾਸ ਨਾਲ ਇੱਕ ਜਿਉਂਦਾ ਜਾਗਤਾ ਪ੍ਰਤੀਕ ਹੈ ਆਓ ਦੇਖਦੇ ਹਾਂ ਕਿਵੇਂ ਖੁਸ਼ੀ ਅਤੇ ਉਤਸ਼ਾਹ ਦਾ ਪ੍ਰਗਟਾਵਾ ਭੰਗੜਾ ਪੰਜਾਬੀਆਂ ਨੂੰ ਖੁੱਲ੍ਹੇ ਦਿਲ ਅਤੇ ਉਤਸ਼ਾਹ ਨੂੰ ਦਰਸਾਉਂਦਾ ਹੈ ਇਹ ਖੁਸ਼ੀ ਦੋ ਮੌਕੀ ਜਿਵੇਂ ਕਿ ਵਿਆਹਵਾਂ ਤਿਉਹਾਰਾਂ ਢਾਡੀਆਂ ਦੇ ਸਮੇਂ ਕੀਤਾ ਜਾਂਦਾ ਹੈ ਵਾਡੀਆਂ ਸਮੇਂ ਕੀਤਾ ਜਾਂਦਾ ਹੈ ਅਤੇ ਪੰਜਾਬੀਆਂ ਨੂੰ ਜੀਉਣ ਪ੍ਰਤੀਕ ਸਰਨਾਪਕਮ ਪਰਚੋਣ ਨੂੰ ਦਰਸਾਉਂਦਾ ਹੈ ਪੰਜਾਬੀ ਲੋਕ ਸੰਗੀਤ ਭੰਗੜਾ ਪੰਜਾਬੀ ਲੋਕ ਸੰਗੀਤ ਨਾਲ ਜੁੜਿਆ ਹੋਇਆ ਹੈ ਜਿਸ ਕੋਲ ਢੋਲ ਤੂੰਬੀ ਅਤੇ ਚਿਮਟੇ ਵਰਗੇ ਰਵਾਇਤੀ ਸਾਜਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਸਾਜ ਪੰਜਾਬ ਦੀ ਮਿੱਟੀ ਨੂੰ ਮਹਿਕ ਅਤੇ ਰੂਹ ਨੂੰ ਸਾਡੇ ਤੱਕ ਪਹੁੰਚਾਉਂਦੇ ਹਨ ਪਹਿਰਾਵਾ ਭੰਗੜਾ ਕਰਦੇ ਸਮੇਂ ਪੰਜਾਬੀ ਰਿਵਾਇਤੀ ਪਹਿਰਾਵਾ ਪਾਇਆ ਜਾਂਦਾ ਹੈ ਜਿਵੇਂ ਕਿ ਰੰਗੀਨ ਤੁਰਲੇ ਵਾਲੀਆਂ ਪੱਗਾਂ ਚਾਦਰੇ ਅਤੇ ਕੁੜਤੇ ਇਹ ਪਹਿਰਾਵਾ ਪੰਜਾਬ ਦੇ ਰੰਗੀਨ ਸੱਭਿਆਚਾਰ ਅਤੇ ਰਵਾਤੀਨ ਪਲਾਂ ਨੂੰ ਦਰਸਾਉਂਦਾ ਹੈ